ਜਿਵੇਂ ਕਿ ਅਸੀਂ ਅੱਜ ਕੱਲ੍ਹ ਦੇਖਦੇ ਹੀ ਹੈਗੇ ਆ ਕਿ ਲ ਪੰਜਾਬੀ ਸੱਭਿਆ ਦੇ ਨੌਜਵਾਨ ਨਸ਼ਿਆਂ ਵੱਲੋਂ ਢੁੱਕਦੇ ਜਾ ਰਹੇ ਹਨ ਅਤੇ ਉਹਨਾਂ ਦਾ ਖੇਡਾਂ ਵੱਲੋਂ ਬਿਲਕੁਲ ਹੀ ਰੁਚੀ ਘੱਟਦੀ ਜਾ ਰਹੀ ਹੈਗੀ ਹੈ ਜੇ ਅਸੀਂ ਨੌਜਵਾਨਾਂ ਨੂੰ ਖੇਡਾਂ ਦੇ ਲਈ ਉਤਸ਼ਾਹਿਤ ਕਰਨਾ ਹੈਗਾ ਅਤੇ ਉਹਨਾਂ ਦੇ ਬਹੁਤ ਸਾਰੀਆਂ ਸਹੂਲਤਾਂ ਸਾਨੂੰ ਉਹਨਾਂ ਨੂੰ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਜਿਵੇਂ ਕਿ ਖੇਡਾਂ ਦੇ ਵਿੱਚ ਜੇ ਕਿਸੇ ਨੇ ਯੋਗਦਾਨ ਲੈਣਾ ਹੈਗਾ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਇੱਕ ਚੰਗੀ ਤਰ੍ਹਾਂ ਟੀਮ ਦੀ ਸਲੈਕਸ਼ਨ ਹੋਣੀ ਚਾਹੀਦੀ ਹੈ ਜਦੋਂ ਉਹ ਟੀਮ ਦੀ ਸਲੈਕਸ਼ਨ ਦੇ ਲਈ ਜਾਂਦੇ ਹਨ ਤਾਂ ਉਹਨਾਂ ਦੇ ਨਾਲ ਚੰਗੀ ਤਰ੍ਹਾਂ ਵਿਵਹਾਰ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਉਹਨਾਂ ਨੂੰ ਚੰਗੀ ਤਰ੍ਹਾਂ ਟਰੀਟ ਕੀਤਾ ਜਾਂਦਾ ਹੈਗਾ ਏ ਆ ਜਿੱਦਾਂ ਉਹ ਮਤਲਬ ਕਿ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਹੀ ਘੁੰਮਾਉਂਦੇ ਹਨ ਅਤੇ ਫਿਰ ਜੇ ਉਹਨਾਂ ਨੂੰ ਟੀਮ ਵਿੱਚ ਰੱਖ ਹੀ ਲੈਂਦੇ ਹੈਗੇ ਆ ਤਾਂ ਉਹਨਾਂ ਦੇ ਨਾਲ ਬਹੁਤ ਹੀ ਗੰਦਾ ਸਲੂਕ ਕੀਤਾ ਜਾਂਦਾ ਹੈਗਾ ਏ ਕਿ ਤੁਹਾਨੂੰ ਕੁਛ ਨਹੀਂ ਆਉਂਦਾ ਹੈਗਾ ਇੱਦਾਂ ਕਹਿ ਕੇ ਉਹਨਾਂ ਨੂੰ ਉਤਸ਼ਾਹਿਤ ਨਹੀਂ ਸਮਾਂ ਕਿ ਉਹਨਾਂ ਨੂੰ ਡੀਮੋਟੀਵੇਟ ਕਰਦੇ ਰਹਿੰਦੇ ਹਨ ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਖੇਡਾਂ ਵੱਲ ਧਿਆਨ ਘੱਟਦਾ ਜਾ ਰਿਹਾ ਹੈਗਾ ਆ ਅਤੇ ਬੇਰੁਜ਼ਗਾਰੀ ਦੇ ਕਾਰਨ ਉਹਨਾਂ ਦਾ ਨਸ਼ਿਆਂ ਵੱਲ ਨੂੰ ਧਿਆਨ ਵੱਧਦਾ ਜਾ ਰਿਹਾ ਹੈ ਜੇ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਾਂਗੇ ਤਾਂ ਅਸੀਂ ਆਪਣੇ ਪੰਜਾਬ ਦੇ ਲੋ ਜਿੰਨੇ ਵੀ ਨੌਜਵਾਨ ਹਨ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹੈਗੇ ਹਾਂ ਸਾਨੂੰ ਨਸ਼ਿਆਂ ਤੋਂ ਉਹਨਾਂ ਨੂੰ ਦੂਰ ਕਰਨ ਦੇ ਲਈ ਉਹਨਾਂ ਨੂੰ ਖੇ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਉਹਨਾਂ ਦੇ ਖਾਣ ਦੇ ਰਿਲੇਟਿਡ ਸਾਰੀਆਂ ਸਹੂਲਤਾਂ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਹਨ ਉਹਨਾਂ ਦੇ ਪਹਿਰਾਵੇ ਦੇ ਰਿਲੇਟਡ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਦੇ ਰਹਿਣ ਦਾ ਵੀ ਬੰਦੋਬਸਤ ਸਾਨੂੰ ਵਧੀਆ ਢੰਗ ਦੇ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਹਿੱਸਾ ਲੈ ਸਕਣ